ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਅੱਜ ਕੱਲ੍ਹ ਗੱਲ ਆਪਾਂ ਕਰੀਏ ਖੇਡਾਂ ਦੀ ਅਤੇ ਪਿੰਡਾਂ ਵਿੱਚ ਜ਼ਿਆਦਾਤਰ ਲੋਕ ਖੇਡਣਾ ਬਹੁਤ ਹੀ ਪਸੰਦ ਕਰਦੇ ਹਨ ਅਤੇ ਪਿੰਡਾਂ ਵਿੱਚ ਬਹੁਤ ਹੀ ਜ਼ਿਆਦਾ ਗੇਮਾਂ ਖੇਡੀਆਂ ਜਾਂਦੀਆਂ ਹਨ ਲ ਜਿਵੇਂ ਕਿ ਫੁੱਟਬੋਲ ਕ੍ਰਿਕਟ ਵਾਲੀਵੋਲ ਕਬੱਡੀ ਕੁਸ਼ਤੀ ਕੁਸ਼ਤੀ ਅਤੇ ਇਸ ਖੇਡਾਂ ਨਾਲੋਂ ਹਰ ਇਨ੍ਹਾਂ ਖੇਡਾਂ ਵਿੱਚੋਂ ਬਹੁਤ ਹੀ ਜ਼ਿਆਦਾ ਲੋਕਾਂ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੀਆਂ ਹਨ ਅਤੇ ਖੇਡਾਂ ਵਿੱਚ ਲੋਕ ਬਹੁਤ ਹੀ ਕੁਛ ਸਿੱਖਣ ਨੂੰ ਮਿਲਦਾ ਹੈ ਜ ਜਿਵੇਂ ਕਿ ਲੀਡਰਸ਼ਿਪ ਹੋਈ ਆ ਆਪਸੀ ਪਿਆਰ ਅਤੇ ਇਹ ਲ ਸਾਡੇ ਲਈ ਬਹੁਤ ਹੀ ਚੰਗਾ ਚੰਗੀ ਗੱਲ ਹੈ ਸਿਹਤ ਦੇ ਨਾਲ਼ ਨਾਲ਼ ਹੀ ਲੋਕ ਸਾਡੇ ਪਿੰਡਾਂ ਵਿੱਚੋਂ ਨਸ਼ਾ ਵੀ ਦੂਰ ਹੁੰਦਾ ਹੈ ਅਤੇ ਜਿਹਦੇ ਕਾਰਨ ਪਿੰਡਾਂ ਵਿੱਚ ਨਿਆਣੇ ਜ਼ਿਆਦਾਤਰ ਖੇਡਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ